ਸਾਲ ਦੌਰਾਨ ਪੰਜਾਬ ਵਿੱਚ ਮਨੋਰੰਜਨ ਦਾ ਦ੍ਰਿਸ਼ ਬਹੁਤ ਤਰੀਕੇ ਨਾਲ ਬਦਲਿਆ ਹੈ ਜਿਵੇਂ ਕਿ ਆਪਾਂ ਸਭ ਨੂੰ ਪਤਾ ਹੈ ਪਹਿਲਾਂ ਮੋਬਾਈਲ ਨਹੀਂ ਹੁੰਦੇ ਸਨ ਵੀਡੀਓ ਗੇਮਾਂ ਨਹੀਂ ਹੁੰਦੀਆਂ ਸਨ ਤਾਂ ਬੱਚੇ ਆਊਟਡੋਰ ਗੇਮ ਬਾਹਰ ਜਾ ਕੇ ਇਨਡੋਰ ਗੇਮ ਅੰਦਰ ਬੈਠ ਕੇ ਕੈਰਮ ਬੋਰਡ ਲੂਡੋ ਵਗੈਰਾ ਵਗੈਰਾ ਬਹੁਤ ਤਰੀਕੇ ਨਾਲ ਖੇਡਦੇ ਹੁੰਦੇ ਸਨ ਪਰ ਹੁਣ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਗੈਜਟਸ ਜਿਹੜੇ ਆ ਗਏ ਹਨ ਉਹ ਇਲੈਕਟਰੋਨਿਕ ਗੈਜਟ ਜੋ ਕਿ ਮੋਬਾਈਲਾਂ ਮੋਬਾਈਲ ਫੋਨ ਦੇ ਵਿੱਚ ਗੇਮ ਵੀਡੀਓ ਗੇਮ ਵਰਗੇ ਹੁੰਦੇ ਹਨ ਵੀਡੀਓ ਗੇਮ ਨੇ ਬੱਚਿਆਂ ਦੇ ਮਨ ਵਿੱਚ ਬਾਹਰ ਜਾ ਕੇ ਖੇਡਣ ਦਾ ਉਤਸ਼ਾਹ ਜੋ ਕਿ ਖਤਮ ਕਰ ਦਿੱਤਾ ਹੈ ਟਰੈਵਲਿੰਗ ਜੋ ਕਿ ਟਰੈਵਲਿੰਗ ਜ਼ਿੰਦਗੀ ਦਾ ਇਹ ਇੱਕ ਇਹ ਹਿੱਸਾ ਹੈ ਜੋ ਕਿ ਮ ਮਨੁੱਖ ਨੂੰ ਖੁਸ਼ ਅਤੇ ਸ਼ਾਂਤੀ ਪ੍ਰਦਾਨ ਕਰਦਾ ਹੈ ਜਿੱਦਾਂ ਕਿ ਸਾਨੂੰ ਪਤਾ ਹੈ ਕਿ ਅਸੀਂ ਵੱਡੇ ਵੱਡੇ ਪਹਾੜਾਂ ਬਾਹਰ ਜਾ ਕੇ ਪਹਾੜਾਂ 'ਤੇ ਘੁੰਮਦੇ ਹਾਂ ਤਾਂ ਮਨ ਸ਼ਾਂਤ ਹੁੰਦਾ ਹੈ ਅਤੇ ਮਨ ਦੀ ਤਸੱਲੀ ਸੰਤੁਸ਼ਟੀ ਵੀ ਮਿਲਦੀ ਹੈ ਕਈ ਥਾਵਾਂ 'ਤੇ ਟਰੈਵਲਿੰਗ ਕਰਨ ਨਾਲ ਜਿੱਦਾਂ ਕਿ ਪਹਾੜਾਂ 'ਤੇ ਜਾ ਕੇ ਅਨੰਦਪੁਰ ਸਾਹਿਬ ਵਾਲੇ ਰਸਤੇ 'ਤੇ ਜਾਂਦੇ ਹਾਂ ਹੀ ਸ ਮਨ ਨੂੰ ਸ਼ਾਂਤੀ ਅਤੇ ਖੁਸ਼ੀ ਮਿਲਦੀ ਹੈ ਬਾਹਰ ਜਾ ਕੇ ਖੇਡਣ ਵਾਲੀਆਂ ਗੇਮਾਂ ਜਿਵੇਂ ਕਿ ਕ੍ਰਿਕਟ ਫੁੱਟਬਾਲ ਵਾਲੀਬਾਲ ਕਬੱਡੀ ਖੋ ਖੋ ਵਗੈਰਾ ਵਗੈਰਾ ਗੇਮਾਂ ਖੇਡੀਆਂ ਜਾਂਦੀਆਂ ਹਨ ਉਸ ਉਹਨਾਂ ਦਾ ਸਭ ਉਹ ਸਭ ਖਤਮ ਹੋ ਕੇ ਸਿਰਫ ਹੁਣ ਗੈਜਟਾਂ ਵੀਡੀਓ ਗੇਮਾਂ ਮੋਬਾਈਲ ਫੋਨ ਹੀ ਰਹਿ ਗਿਆ ਹੈ ਇਹਨਾਂ ਨੇ ਬੱਚਿਆਂ ਨੂੰ ਬਹੁਤ ਹੀ ਖਰਾਬ ਕਰ ਦੇਣਾ ਹੈ